ਮੈਨੂੰ ਕਈ ਤਰ੍ਹਾਂ ਦੀਆਂ ਫੋਟੋਆਂ ਖਿੱਚਣੀਆਂ ਅੱਛੀਆਂ ਲੱਗਦੀਆਂ ਹਨ ਜਿਵੇਂ ਕਿ ਪ੍ਰਵਾਸੀ ਪੰਛੀ ਅਲੋਪ ਹੋ ਰਹੀਆਂ ਚਿੜੀਆਂ ਫੁੱਲ ਬਾਗ ਬਗੀਚੇ ਇਤਿਹਾਸਿਕ ਨਿਸ਼ਾਨੀਆਂ